ਇੱਕ ਹਜਾਰ ਨਾਨਮੇ ਦੋ ਹਜਾਰ ਨੱਤੀ ਇੱਕ ਹਜਾਰ ਅੜਿਨਮੇ ਦੋ ਹਜਾਰ ਦੋ ਸੌ ਨਾਨਮੇ ਇੱਕ ਲੱਖ ਪੰਦਰਾਂ ਹਜਾਰ ਦੋ ਸੌ ਨਾਨਮੇ